ਪੁਰਾਣੇ ਸਮੇਂ ਵਿੱਚ ਰੈਡੀਮੈਂਟ ਕੱਪੜੇ ਨਹੀਂ ਹੁੰਦੇ ਸੀ ਲੋਕ ਹੱਥੀ ਬਣਾਏ ਕੱਪੜੇ ਪਾਉਂਦੇ ਹੁੰਦੇ ਸੀ ਕਿਉਂਕੀ ਉਸ ਟਾਈਮ ਕੱਪੜਿਆਂ ਦੀ ਸ਼ੋਪ ਨਹੀਂ ਹੁੰਦੀ ਸੀ ਔਰਤੇ ਜੋ ਕੱਪੜੇ ਬੁਣਦੇ ਹੁੰਦੇ ਸੀ ਬੱਚਿਆਂ ਦੇ ਕੱਪੜੇ ਹੀ ਉਹਦੀ ਬੁਣਦੇ ਹੁੰਦੇ ਸੀ ਅਤੇ ਸਾਰੇ ਹੀ ਕੱਪੜੇ ਪਾਉਂਦੇ ਹੁੰਦੇ ਸੀ ਸਭ ਨੂੰ ਇਹ ਬੁਣੇ ਹੋਏ ਕੱਪੜੇ ਹੀ ਦੀ ਹੀ ਆਦਤ ਸੀ ਅਤੇ ਹੁਣ ਦੇ ਸਮੇਂ ਵਿੱਚ ਬੁ ਬਹੁਤ ਸਾਰੇ ਮਸ਼ੀਨਾਂ ਆ ਚੁੱਕੀਆਂ ਹਨ ਜਿਨਾਂ ਨਾਲ ਆਪਣੇ ਆਪ ਹੀ ਕੱਪੜਾ ਬਣ ਜਾਂਦਾ ਹੈ ਅਤੇ ਲੋਕ ਨੂੰ ਇਹ ਸਭ ਇਹ ਬਹੁਤ ਵਧੀਆ ਲੱਗਦਾ ਹੈ ਇਹ ਕੱਪੜਾ ਪਾਉਂਦੇ ਹਨ ਕਈ ਲੋਕ ਹੁਣ ਦੇ ਸਮੇਂ ਵਿੱਚ ਬੁਣੇ ਹੋਏ ਕੱਪੜੇ ਪਾਉਂਦੇ ਹਨ ਅਤੇ ਜ਼ਿਆਦਾ ਲੋਕ ਰੈਡੀਮੈਂਟ ਕੱਪੜੇ ਹੀ ਪਸੰਦ ਕਰਦੇ ਹਨ